ਉੱਨੀ ਸੌ ਤਰਾਨਵੇਂ ਦੇ ਵਿੱਚ ਬੜਾ ਨੁਕਸਾਨ ਹੋਇਆਂ ਅਤੇ ਬੜੇ ਹੜ੍ਹ ਆਏ ਲੋਕਾਂ ਦੇ ਘਰ ਢੇਰੀ ਢਹਿ ਹੋ ਗਏ ਅਤੇ ਬੜਾ ਨੁਕਸਾਨ ਹੋਇਆਂ ਲੋਕਾਂ ਦੇ ਡੰਗਰ ਪਸ਼ੂ ਹੜ੍ਹ ਗਏ ਅਨੇਕਾਂ ਪ੍ਰਕਾਰ ਦੇ ਜਿਹੜੇ ਕੱਚੇ ਮਕਾਨ ਸੀ ਉਨ੍ਹਾਂ ਦੇ ਵਿੱਚ ਪਾਣੀ ਵੜ੍ਹ ਗਿਆਂ ਲੋਕਾਂ ਦਾ ਸਮਾਨ ਖਰਾਬ ਹੋ ਗਿਆ ਹੋਰ ਜਿਹੜਾ ਦਰਿਆ ਸੀ ਉਹ ਬੜਾ ਤਬਾਹੀ ਲੈ ਕੇ ਆਇਆ ਬਹੁਤ ਲੋਕਾਂ ਦੇ ਨੁਕਸਾਨ ਹੋਏ ਨੇ ਅਤੇ ਜਿਹੜਾ ਸਮਾਨ ਸੀ ਲੋਕਾਂ ਦਾ ਉਹ ਪਾਣੀ ਦੇ ਵਿੱਚ ਵਹਿ ਤੁਰਿਆਂ ਅਤੇ ਜਿਹੜੇ ਡੰਗਰ ਪਸ਼ੂ ਜਿਹੜੀਆਂ ਮਸ਼ੀਨਰੀਆਂ ਕਾਰ ਗੱਡੀਆਂ ਉਹ ਵੀ ਪਾਣੀ ਦੇ ਵਿੱਚ ਢਹਿ ਤੁਰੀਆਂ ਬਹੁਤ ਲੋਕਾਂ ਦਾ ਘਰ ਦੇ ਅੰਦਰ ਤੱਕ ਬੈੱਡਾਂ ਤੱਕ ਪਾਣੀ ਅੰਦਰ ਤੱਕ ਵੜ੍ਹ ਗਿਆ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਨ੍ਹਾਂ ਕੋਲ ਵਿਚਾਰਿਆ ਕੋਲ ਛੱਤ ਨਹੀਂ ਸੀ ਝੋਪੜੀਆਂ 'ਚ ਰਹਿ ਰਹੇ ਸੀ ਉਨ੍ਹਾਂ ਦਾ ਵਿਚਾਰਿਆਂ ਦਾ ਨੁਕਸਾਨ ਹੋਇਆ ਬਹੁਤ ਪ੍ਰਕਾਰ ਦਾ ਨੁਕਸਾਨ ਜਿਹੜਾ ਹੋਇਆ ਸੀ ਸਾਡਾ ਉੱਨੀਂ ਸੌ ਤਰਾਨਵੇਂ ਦੇ ਵਿੱਚ ਹੋਇਆ ਸੀ ਸਦਾ ਇਲਾਕੇ ਦੇ ਲੋਕ ਬਹੁਤ ਹੀ ਪ੍ਰਭਾਵਿਤ